ਦੌੜ ਵੱਖ ਵੱਖ ਮੌਸਮ ਸਥਿਤੀਆਂ ਵਿੱਚ ਅਲੱਗ ਅਲੱਗ ਤਰੀਕੇ ਨਾਲ ਲ ਲਗਾਈ ਜਾ ਸਕਦੀ ਹੈ ਜਿਵੇਂ ਕਿ ਗਰਮੀ ਦੇ ਮੌਸਮ ਵਿੱਚ ਹੌਲ਼ੇ ਕੱਪੜੇ ਪਾਉਣੇ ਚਾਹੀਦੇ ਹਨ ਲੋ ਲੋਅਰ ਟੀ ਸ਼ਰਟ ਅਤੇ ਮੂੰਹ 'ਤੇ ਕੱਪੜਾ ਨਹੀਂ ਲੈਣਾ ਚਾਹੀਦਾ ਇਸ ਨਾਲ ਜੇ ਮੂੰਹ ਤੋਂ ਕੱਪੜਾ ਲੈਂਦੇ ਤਾਂ ਸਾਹ ਦੀ ਦਿੱਕਤ ਆ ਸਕਦੀ ਆਪਾਂ ਨੂੰ ਤਾਂ ਅਤੇ ਠੰਡ ਦੇ ਮੌਸਮ ਦੇ ਵਿੱਚ ਆਪਾਂ ਨੂੰ ਟਰੈਕ ਸੂਟ ਪਹਿਨਣਾ ਚਾਹੀਦਾ ਤਾਂ ਜੋ ਸਰੀਰ ਗਰਮ ਸਰਦ ਨਾ ਹੋ ਸਕੇ ਅਤੇ ਮ ਬਰਸਾਤ ਦੇ ਮੌਸਮ ਵਿੱਚ ਤਕਰੀਬਨ ਮੀਂਹ ਦੇ ਮੀਂਹ ਪੈਣ 'ਤੇ ਬਰਸਾਤ ਦੇ ਵਿੱਚ ਮੀਂਹ ਪੈਣ ਦੇ ਦੌਰਾਨ ਦੌੜ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਸ ਨਾਲ ਸਰੀਰ ਦਾ ਜੋ ਟੈਂਪਰੇਚਰ ਹੈ ਉਹ ਕਾਫੀ ਘੱਟ ਜਾਂ ਵੱਧ ਹੁੰਦਾ ਰਹਿੰਦਾ ਅਤੇ ਗਰਮ ਸਰਦ ਹੋਣ ਦੇ ਚਾਣਸ ਜ਼ਿਆਦਾ ਹੁੰਦੇ ਆ ਤਕਰੀਬਨ ਬਰਸਾਤ 'ਚ ਦੌੜ ਦਾ ਜੋ ਰੁਝਾਨ ਆ ਉਹ ਘੱਟ ਕਰ ਦੇਣਾ ਚਾਹੀਦਾ ਹੈ